ਹਾਂ ਅਸੀਂ ਬਿਜਲੀ ਦੇ ਖਤਰਿਆਂ ਤੋਂ ਜਾਣੂ ਹਾਂ ਬਿਜਲੀ ਨੂੰ ਜੇਕਰ ਅਸੀਂ ਹੱਥ ਲਗਾਵਾਂਗੇ ਤਾਂ ਉਹ ਸਾਨੂੰ ਬਹੁਤ ਜ਼ੋਰ ਨਾਲ ਝਟਕਾ ਦਿੰਦੀ ਹੈ ਇਸ ਤੋਂ ਬਚਣ ਦੇ ਲਈ ਸਾਨੂੰ ਕਦੇ ਵੀ ਬਿਜਲੀ ਦੀਆਂ ਤਾਰਾਂ ਨੂੰ ਨੰਗੇ ਹੱਥ ਨਹੀਂ ਫੜਨਾ ਚਾਹੀਦਾ ਜੇਕਰ ਕੋਈ ਤਾਰ ਵਿੱਚ ਖਰਾਬੀ ਹੈ ਤਾਂ ਉਸ ਤਾਰ ਨੂੰ ਜਾਂ ਤਾਂ ਬਦਲ ਦਿੱਤਾ ਜਾਣਾ ਚਾਹੀਦਾ ਹੈ ਜਾਂ ਉਸ ਉੱਤੇ ਸੈਲੋ ਟੇਪ ਲਗਾ ਕੇ ਉਸ ਨੂੰ ਢਕ ਦੇਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਕੋਈ ਵੀ ਬੱਚਾ ਜਾਂ ਵਿਅਕਤੀ ਗਲਤੀ ਨਾਲ ਨਾ ਫੜ ਸਕੇ ਬਿਜਲੀ ਦੀ ਤਾਰ ਨੂੰ ਕਦੇ ਵੀ ਗਿੱਲੇ ਹੱਥਾਂ ਦੇ ਨਾਲ ਨਹੀਂ ਫੜਨਾ ਚਾਹੀਦਾ